ਸਾਨੂੰ ਐਲ ਪੀ ਜੀ ਘਰ ਵਿੱਚ ਖਾਣਾ ਬਣਾਉਣ ਵਾਲੀ ਗੈਸ ਅਤੇ ਸਲੰਡਰ ਦੀ ਜਦੋਂ ਵਰਤੋਂ ਕਰਨੀ ਹੈ ਉਸ ਬਾਰੇ ਬਹੁਤ ਸਾਰੀਆਂ ਸੁਰੱਕਸ਼ਾ ਸਾਵਧਾਨੀਆਂ ਦਾ ਉਪਯੋਗ ਕਰਨਾ ਚਾਹੀਦਾ ਹੈ ਜਿਸ ਦਾ ਵੇਰਵਾ ਇਸ ਤਰ੍ਹਾਂ ਹੈ ਨੰਬਰ ਇੱਕ ਜਦੋਂ ਅਸੀਂ ਖਾਣਾ ਪਕਾ ਲੈਣਾ ਹੈ ਉਸ ਵੇ ਸਮੇਂ ਅਸੀਂ ਗੈਸ ਦੇ ਚੁੱਲ੍ਹੇ ਤੋਂ ਸਵਿਚ ਨੂੰ ਬੰਦ ਕਰਕੇ ਬਾਹਰ ਆਉਣਾ ਹੈ ਦੂਸਰੀ ਸਾਵਧਾਨੀ ਹੈ ਕਿ ਜਦੋਂ ਵੀ ਅਸੀਂ ਕੋਈ ਗੈਸ ਸਲੰਡਰ ਲਗਵਾਉਣਾ ਹੈ ਤਾਂ ਸਾਨੂੰ ਉਸ ਦਾ ਰੈਗੂਲੇਟਰ ਗੈਸ ਲੀਕੇਜ ਅਤੇ ਗੈਸ ਦੇ ਪਾਈਪ ਨੂੰ ਪੂਰੀ ਤਰ੍ਹਾਂ ਚੈੱਕ ਕਰਵਾ ਕਰਵਾ ਲੈਣਾ ਚਾਹੀਦਾ ਹੈ ਤੀਸਰੀ ਗੱਲ ਜੋ ਹੈ ਕਿ ਸਾਨੂੰ ਗੈਸ ਸਿਲੰਡਰ ਜਦੋਂ ਰਾਤ ਵੇਲੇ ਖਾਣਾ ਪੀਣਾ ਬਣਾ ਕੇ ਉਸ ਸਮੇਂ ਸਾਨੂੰ ਉਸ ਸਲੰਡਰ ਨੂੰ ਚੁੱਲ੍ਹੇ ਤੋਂ ਹੀ ਨਹੀਂ ਬਲਕਿ ਰੈਗੂਲੇਟਰ ਤੋਂ ਵੀ ਬੰਦ ਕਰ ਦੇਣਾ ਚਾਹੀਦਾ ਹੈ ਚੌਥੀ ਗੱਲ ਸਾਨੂੰ ਗੈਸ ਦੀ ਪੂਰੀ ਸਫਾਈ ਰ ਕਰਵਾਉਣੀ ਚਾਹੀਦੀ ਹੈ ਜਾਂ ਕਰਨੀ ਚਾਹੀਦੀ ਹੈ ਤਾਂ ਜੋ ਖਾਣੇ ਦੇ ਕਾਰਨ ਗੈਸ ਪਾਈਪ ਦੇ ਨਾਲ ਕਿਤੇ ਜੁੜੇ ਨਾ ਹੋਣ ਅਤੇ ਗੈਸ ਸਲੰਡਰ ਦਾ ਏਰੀਆ ਵੀ ਪੂਰੀ ਤਰ੍ਹਾਂ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤਾਂ ਜੋ ਉਸਨੂੰ ਚੂਹੇ ਨਾ ਟੁੱਕ ਸਕਣ ਜਾਂ ਕੀੜੇ ਮਕੌੜੇ ਉਸ 'ਤੇ ਇਹ ਕੋਈ ਕੱਟ ਨਾ ਲਗਾ ਸਕਣ ਜਿਸ ਨਾਲ ਗੈਸ ਲੀਕੇਜ ਦਾ ਖਤਰਾ ਰਹਿੰਦਾ ਹੈ ਨੈ ਅਗਲਾ ਪੁਆਇੰਟ ਹੈ ਕਿ ਸਾਨੂੰ ਸਮੇਂ ਸਮੇਂ ਪਰ 'ਤੇ ਗੈਸ ਦੀ ਸਰਵਿਸ ਕਰਵਾ ਲੈਣੀ ਚਾਹੀਦੀ ਹੈ